ਸਾਡੇ ਖੇਤਰ ਵਿੱਚ ਅਕਸਰ ਹੀ ਦੇਖੇ ਜਾਣ ਵਾਲੇ ਕੁਝ ਪੰਛੀ ਹਨ ਜਿਸ ਤਰ੍ਹਾਂ ਕੋਇਲ ਕਾਂ ਤੋਤਾ ਘੁੱਗੀ ਕਬੂਤਰ ਹੋਰ ਕਈ ਤਰ੍ਹਾਂ ਦੀਆਂ ਕਿਸਮਾਂ ਨੇ ਚਿੜੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਰੰਗ ਬਿਰੰਗੀਆਂ ਚਿੜੀਆਂ ਵੀ ਹੋ ਗਈਆਂ ਟਟੋਲੀਆਂ ਹੋ ਗਈਆਂ ਬੱਤਖਾਂ ਹੋ ਗਈਆਂ ਮੁਰਗੇ ਹੋ ਗਏ ਮੁਰਗੀਆਂ ਹੋ ਗਈਆਂ ਕਈ ਤਰ੍ਹਾਂ ਦੇ ਪੰਛੀ ਨੇ ਜਿਹੜੇ ਸਾਡੇ ਖੇਤਰ ਵਿੱਚ ਵੇਖੇ ਜਾਂਦੇ ਹਨ ਪਰ ਮੇਰੀ ਜ਼ਿਆਦਾ ਪਸੰਦੀਦਾ ਜਾਨਵਰ ਹੈਗਾ ਵਾ ਤੋਤਾ ਕਿਉਂਕਿ ਤੋਤੇ ਨੂੰ ਵੇਖੇ ਦੇਖੇ ਜਾਣ ਵਾਲੀ ਇਹ ਗੱਲ ਹੈ ਕਿ ਤੋਤਾ ਜਿਸ ਤਰ੍ਹਾਂ ਕੋਈ ਇਨਸਾਨ ਬੋਲਦਾ ਤਾਂ ਉਹਨੂੰ ਕਾਪੀ ਵੀ ਕਰ ਜਾਂਦਾ ਉਹਦੀ ਨਕਲ ਕਰ ਜਾਂਦਾ ਹੈ ਜਿਸ ਤਰ੍ਹਾਂ ਉਹ ਬੋਲਣਾ ਸਿੱਖ ਜਾਂਦਾ ਹੈ ਜਿਸ ਤਰ੍ਹਾਂ ਬੋਲੀ ਦਾ ਉਸ ਤਰ੍ਹਾਂ ਬੋਲੀ ਦਾ ਹੈ ਘਰਾਂ ਵਿੱਚ ਰੱਖਿਆ ਜਾਂਦਾ ਹੈ ਬਹੁਤੇ ਲੋਕ ਉਸ ਨੂੰ ਘਰਾਂ ਵਿੱਚ ਰੱਖਣਾ ਵੀ ਪਸੰਦ ਕਰਦੇ ਹਨ ਅਤੇ ਮੈਂ ਵੀ ਜ਼ਿਆਦਾ ਤੋਤੇ ਨੂੰ ਪਸੰਦ ਕਰਦਾ ਹੈ ਇੱਕ ਤਾਂ ਮੈਨੂੰ ਇਹਦਾ ਰੰਗ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਇੱਕ ਇਹਦੇ ਵਿ ਇਹਦੇ ਗਲ ਵਿੱਚ ਲਾਲ ਰੰਗ ਦਾ ਇੱਕ ਗਾਨੀ ਦੀ ਤਰ੍ਹਾਂ ਲਾਈਨ ਪਈ ਹੁੰਦੀ ਹੈ ਜੋ ਮੈਨੂੰ ਜ਼ਿਆਦਾ ਆਕਰਸ਼ਿਤ ਕਰਦੀ ਹੈ ਇਸ ਕਰਕੇ ਮੈਂ ਮੇਰਾ ਪਸੰਦੀਦਾ ਜਾਨਵਰ ਤੋਤਾ ਹੈ